ਪਾਣੀ ਨੂੰ ਫਿਲਟਰ ਕਰਨ ਲਈ ਅਤੇ ਸ਼ੁੱਧ ਕਰਨ ਲਈ ਬਹੁਤ ਸਾਰੇ ਬਰੈਸਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਹਿਲਾਂ ਵਾਲੇ ਲੋਕ ਅਤੇ ਹੁਣ ਵਾਲੇ ਲੋਕਾਂ ਵਿੱਚ ਬਹੁਤ ਫਰਕ ਹੈ ਪਹਿਲਾਂ ਵਾਲਾ ਪਾਣੀ ਸਾਫ ਹੁੰਦਾ ਸੀ ਪਰ ਹੁਣ ਵਾਲੇ ਪਾਣੀ ਵਿੱਚ ਬਹੁਤ ਸਾਰੀਆਂ ਅਸ਼ੁੱਧੀਆਂ ਆਉਂਦੀਆਂ ਹਨ ਹੁਣ ਵਾਲੇ ਲੋਕ ਪਾਣੀ ਨੂੰ ਸਾਫ ਕਰਨ ਲਈ ਫਿਲਟਰ ਦੀ ਵਰਤੋਂ ਕਰਦੇ ਹਨ ਆਰ ਓ ਦੀ ਵਰਤੋਂ ਕਰਦੇ ਹਨ ਪਰ ਪਹਿਲਾਂ ਵਾਲੇ ਲੋਕ ਇਸਦੇ ਬਿਲਕੁਲ ਉਲਟ ਸਨ ਉਹ ਪਾਣੀ ਨੂੰ ਸ਼ੁੱਧ ਕਰਨ ਲਈ ਪਾਣੀ ਨੂੰ ਉਬਾਲਦੇ ਸਨ ਉਸ ਵਿੱਚ ਕੁਝ ਚੀਜ਼ਾਂ ਨੂੰ ਮਿਲਾ ਦਿੰਦੇ ਸਨ ਜਿਸ ਨਾਲ ਪਾਣੀ ਸ਼ੁੱਧ ਹੋ ਜਾਂਦਾ ਸੀ ਪਰ ਹੁਣ ਵਾਲੇ ਲੋਕ ਰਸਾਇਣਿਕ ਚੀਜ਼ਾਂ ਦੀ ਵਰਤੋਂ ਕਰਕੇ ਵੀ ਪਾਣੀ ਨੂੰ ਸ਼ੁੱਧ ਕਰਦੇ ਹਨ ਪਾਣੀ ਨੂੰ ਸ਼ੁੱਧ ਕਰਨ ਲਈ ਅਸੀਂ ਘਰਾਂ ਦੇ ਵਿੱਚ ਫਿਲਟਰ ਲਗਵਾ ਲੈਂਦੇ ਹਾਂ ਜਾਂ ਫਿਰ ਬਾਹਰ ਤੋਂ ਆਰ ਓ ਤੋਂ ਪਾਣੀ ਲੈ ਕੇ ਆਉਂਦੇ ਹਾਂ ਜੋ ਕਿ ਸ਼ੁੱਧ ਹੁੰਦਾ ਹੈ ਬਹੁਤ ਸਾਰੀਆਂ ਚੀਜ਼ਾਂ ਪਾਣੀ ਨੂੰ ਗੰਦਾ ਕਰਦੀਆਂ ਹਨ ਇਸ ਲਈ ਪਾਣੀ ਨਾ ਵਰਤਣਯੋਗ ਹੋ ਜਾਂਦਾ ਹੈ ਇਸ ਲਈ ਸਾਨੂੰ ਆਰ ਓ ਅਤੇ ਫਿਲਟਰ ਦੀ ਲੋੜ ਪੈਂਦੀ ਹੈ ਪਿੰਡਾਂ ਵਾਲੇ ਲੋਕ ਅਜੇ ਵੀ ਪਾਣੀ ਨੂੰ ਸ਼ੁੱਧ ਕਰਨ ਲਈ ਪਾਣੀ ਨੂੰ ਉਬਾਲਦੇ ਹਨ ਘੜੇ ਦੀ ਵਰਤੋਂ ਕਰਦੇ ਹਨ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਪਰ ਸ਼ਹਿਰਾਂ ਵਾਲੇ ਲੋਕ ਪਾਣੀ ਵਿੱਚ ਟੈਂਕੀਆਂ ਵਿੱਚ ਕੁਝ ਕੁ ਇਸ ਤਰ੍ਹਾਂ ਦੀ ਵਰਤੋਂ ਕਰਦੇ ਹਨ ਕਿ ਰਸਾਈਣਿਕ ਗੋਲੀਆਂ ਜਾਂ ਰਸਾਈਣਿਕ ਪਾਊਡਰ ਪਾਉਂਦੇ ਹਨ ਜਿਸ ਨਾਲ ਕਿ ਪਾਣੀ ਸ਼ੁੱਧ ਹੋ ਜਾਂਦਾ ਹੈ ਪਰ ਪਾਣੀ ਵਿੱਚ ਜੋ ਚੀਜ਼ਾਂ ਸਹੀ ਹੁੰਦੀਆਂ ਹਨ ਕਈ ਵਾਰ ਉਹ ਵੀ ਮਰ ਜਾਂਦੀਆਂ ਹਨ ਪਾਣੀ ਨੂੰ ਵਾਰ ਵਾਰ ਫਿਲਟਰ ਕਰਨ ਨਾਲ ਉਸ ਵਿੱਚ ਜੋ ਤਾਕਤ ਹੁੰਦੀ ਹੈ ਪਾਣੀ ਨੂੰ ਪੀ ਕੇ ਜੋ ਸਾਨੂੰ ਸੰਤੁਸ਼ਟੀ ਮਿਲਦੀ ਹੈ ਉਹ ਸਾਨੂੰ ਸੰਤੁਸ਼ਟੀ ਨਹੀਂ ਮਿਲਦੀ ਜਿਸ ਨਾਲ ਪਾਣੀ ਨੂੰ ਫਿਲਟਰ ਵਾਰ ਵਾਰ ਕਰਨ ਨਾਲ ਸਾਡੇ ਸਰੀਰ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ ਧੰਨਵਾਦ